ਜੁੱਤੀ ਸਾਡੇ ਦੇਸ਼ ਦੇ ਸਾਡੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਦੋ ਮਸ਼ੂਹੂਰ ਕਾਰੋਬਾਰ ਹੈਗੇ ਨੇ ਪਹਿਲਾਂ ਤਾਂ ਨੰਬਰ 'ਤੇ ਜੁੱਤੀ ਹੈ ਜੁੱਤੀ ਸਾਡੇ ਸ਼ਹਿਰ ਦੇ ਵਿੱਚ ਬੜੀ ਮਸ਼ਹੂਰ ਹੈ ਅਤੇ ਇੱਥੋਂ ਜੁੱਤੀਆਂ ਬਣ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੀਆਂ ਨੇ ਕਢਾਈ ਵਾਲੀਆਂ ਵੀ ਜਾਂਦੀਆਂ ਨੇ ਸਿੰਪਲ ਵੀ ਜਾਂਦੀਆਂ ਨੇ ਇਹ ਚਮੜੇ ਦੀਆਂ ਬਣੀਆਂ ਹੁੰਦੀਆਂ ਨੇ ਅਤੇ ਦੁ ਦੂਸਰਾ ਸਾਡੇ ਸ਼ਹਿਰ ਦੇ ਵਿੱਚ ਫਾਜ਼ਿਲਕਾ ਵਿੱਚ ਤੋਸ਼ਾ ਮਸ਼ਹੂਰ ਏ ਤੋਸ਼ਾ ਸਾਡੇ ਇੰਨਾ ਫੇਮਸ ਹੈ ਜੀ ਦੇਸ ਪ੍ਰਦੇਸ ਸਭ ਲੈ ਜਾਂਦੇ ਨੇ ਇਹਦਾ ਟੇਸਟ ਵੀ ਬੜਾ ਵਧੀਆ ਹੁੰਦਾ ਹੈ ਅਤੇ ਜਿਹੜੇ ਬਣਾਉਣ ਵਾਲੇ ਕਾਰੀਗਰ ਨੇ ਉਹ ਵੀ ਬੜੀ ਮਿਹਨਤ ਨਾਲ ਬਣਾਉਂਦੇ ਨੇ ਇਹ ਕਈ ਦਿਨ ਰੱਖ ਲੋ ਇਹ ਖਰਾਬ ਨਹੀਂ ਹੁੰਦਾ ਜਿੰਨੇ ਦਿਨ ਮਰਜ਼ੀ ਰੱਖ ਲਈਏ ਆਪਾਂ ਤੀਸਰਾ ਇਹ ਵੀ ਜਿਹੜਾ ਆਪਾਂ ਮਕਾਨ ਬਣਾਉਣੇ ਹੈ ਵੀ ਰੇਤੇ ਦੀ ਲੋੜ ਹੁੰਦੀ ਸਾਡੇ ਫਾਜ਼ਿਲਕਾ ਸ਼ਹਿਰ 'ਚ ਰੇਤੇ ਦੀਆਂ ਖੱਡਾਂ ਹੈਗੀਆਂ ਰੇਤੇ ਤੋਂ ਬਗੈਰ ਆਪਾਂ ਕੋਈ ਮਕਾਨ ਨਹੀਂ ਬਣਾ ਸਕਦੇ ਇਸ ਕਰਕੇ ਸਾਨੂੰ ਰੇਤੇ ਦੀ ਬੜੀ ਜ਼ਰੂਰਤ ਰਹਿੰਦੀ ਹੈ